ਸਾਡੇ ਪਿੰਡ ਵਿੱਚ ਪਹਿਲਾਂ ਨਲਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੌਲੀ ਹੌਲੀ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਰਕੇ ਨਹਿਰੀ ਪਾਣੀ ਦੀ ਵਰਤੋਂ ਸ਼ੁਰੂ ਹੋ ਗਈ ਜਿਸ ਦੇ ਲਈ ਸਰਕਾਰੀ ਟੂਟੀਆਂ ਲਗਾਈਆਂ ਗਈਆਂ ਪਹਿਲਾਂ ਇਹ ਸਰਕਾਰੀ ਟੂਟੀਆਂ ਹਰ ਗਲੀ ਦੇ ਵਿੱਚ ਇੱਕ ਗ ਇੱਕ ਜਿਹੜੀ ਟੂਟੀ ਆ ਉਹ ਲਗਵਾਈ ਗਈ ਪਰ ਹੌਲੀ ਹੌਲੀ ਪਾਣੀ ਦੀ ਵਰਤੋਂ ਜ਼ਿਆਦਾ ਹੋਣ ਲੱਗੀ ਅਤੇ ਇਹਦੀ ਲੋੜ ਜ਼ਿਆਦਾ ਮਹਿਸੂਸ ਹੋਈ ਤਾਂ ਹਰ ਘਰ ਦੇ ਵਿੱਚ ਸਰਕਾਰੀ ਟੂਟੀ ਲੱਗੀ ਜਿਸਦੇ ਵਿੱਚ ਨਹਿਰੀ ਪਾਣੀ ਆਉਂਦਾ ਗਾ ਪਰ ਇਸ ਪਾਣੀ ਦੀ ਇੱਕ ਟਾਈਮਿੰਗ ਆ ਜਿਹੜਾ ਕਿ ਸਵੇਰੇ ਨੌ ਵਜੇ ਅਤੇ ਸ਼ਾਮ ਨੂੰ ਤਿੰਨ ਵਜੇ ਆਉਂਦਾ ਸਿਰਫ ਦਿਨ ਦੇ ਵਿੱਚ ਦੋ ਵਾਰ ਹੀ ਪਾਣੀ ਆਉਂਦਾ ਗਾ ਅਤੇ ਆਉਂਦਾ ਵੀ ਇੱਕ ਘੰਟੇ ਦੇ ਲਈ ਆ ਪਰ ਪਾਣੀ ਦੀ ਜਿਹੜੀ ਵਰਤੋਂ ਆ ਹੁਣ ਬਹੁਤ ਜ਼ਿਆਦਾ ਵੱਧ ਗਈ ਆ ਸਾਨੂੰ ਰਸੋਈ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਅਤੇ ਕੱਪੜੇ ਧੋਣ ਦੇ ਲਈ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਗਈ ਜਿਹਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈਗੀ ਉਸਦੇ ਉਸ ਦੇ ਇਲਾਵਾ ਜਿਹੜਾ ਫਲੱਸ਼ਾਂ ਦੇ ਵਿੱਚ ਆ ਬਹੁਤ ਜ਼ਿਆਦਾ ਪਾਣੀ ਵਰਤੋਂ ਵਿੱਚ ਆਉਂਦਾ ਗਾ ਪਰ ਪਾਣੀ ਦੀ ਇੱਕ ਟਾਈਮਿੰਗ ਹੋਣ ਕਰਕੇ ਬਹੁਤ ਘੱਟ ਪਾਣੀ ਅਸੀਂ ਰੱਖ ਸਕਦੇ ਹਾਂ ਪਰ ਸਾਨੂੰ ਲੋੜ ਜ਼ਿਆਦਾ ਹੁੰਦੀ ਆ ਜਿਹਦੇ ਨਾਲ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈਗੀ ਕਿਉਂਕਿ ਕਈ ਕਈ ਦਿਨ ਤਾਂ ਜਦੋਂ ਪਾਈਪਾਂ ਦਾ ਕੰਮ ਆਉਂਦਾ ਹੁੰ ਹੁੰਦਾ ਉਦੋਂ ਪਾਣੀ ਦੀ ਸਪਲਾਈ ਆਉਂਦੀ ਹੀ ਨਹੀਂ ਅਤੇ ਜਦੋਂ ਨਹਿਰਾਂ ਦੇ ਵਿੱਚ ਪਾਣੀ ਸੁੱਕ ਜਾਂਦਾ ਉਦੋਂ ਵੀ ਕਾਫੀ ਦਿਨਾਂ ਤੱਕ ਪਾਣੀ ਜਿਹੜਾ ਬੰਦ ਰਹਿੰਦਾ ਗਾ ਅਤੇ ਪਾਣੀ ਦੀ ਜਿਹੜੀ ਘਾਟ ਆ ਉਹ ਸਾਨੂੰ ਮਹਿਸੂਸ ਹੁੰਦੀ ਹੈਗੀ ਕਿਉਂਕਿ ਟੈਂਕੀਆਂ ਦੇ ਵਿੱਚ ਪਾਣੀ ਖਤਮ ਹੋ ਜਾਂਦਾ ਗਾ ਅਤੇ ਉਸ ਟਾਈਮ ਦੇ ਵਿੱਚ ਅਸੀਂ ਟੂਟੀ ਦੇ ਲਈ ਦੁਬਾਰਾ ਉਹਨਾਂ ਨੂੰ ਫੋਨ ਨਹੀਂ ਕਰ ਸਕਦੇ ਗੇ ਜੋ ਤੁਸੀਂ ਛੱਡ ਦਿਉ ਕਿਉਂਕਿ ਉਹਦੀ ਇੱਕ ਟਾਈਮਿੰਗ ਆ ਗੀ ਅਤੇ ਜਦੋਂ ਪਾਣੀ ਖਤਮ ਹੋ ਜਾਂਦਾ ਗਾ ਉਦੋਂ ਸਾਨੂੰ ਪਾਣੀ ਦੀ ਜਿਹੜੀ ਘਾਟ ਹੈ ਉਹ ਮਹਿਸੂਸ ਹੁੰਦੀ ਹੈ